ਟੈਕਨਾਲੋਜੀ ਨੇ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਅੱਜ ਜਿੱਥੇ ਪੰਜਾਬ ਦੇ ਸਕੂਲਾਂ ਵਿੱਚ ਵਧੀਆ ਟੈਕਨਾਲੋਜੀ ਨਾਲ ਪੜ੍ਹਾਇਆ ਜਾ ਰਿਹਾ ਹੈ ਉੱਥੇ ਆਡੀਓ ਵੀਡੀਓ ਏਡਸ ਦੇ ਨਾਲ ਬੱਚਿਆਂ ਨੂੰ ਨਵੀਂ ਆਧੁਨਿਕ ਸਿੱਖਿਆ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ ਨਵੇਂ ਨਵੇਂ ਤਰੀਕੇ ਦੇ ਜੋ ਹੈ ਵਿਗਿਆਨਕ ਤਜਰਬਿਆਂ ਵਿਗਿਆਨਕ ਖੋਜਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਬੱਚੇ ਜੋ ਹੈ ਇਹਨਾਂ ਤੋਂ ਬਹੁਤ ਕੁਝ ਸਿੱਖ ਰਹੇ ਹਨ ਜਿੱਥੇ ਜਿਵੇਂ ਪੁਲਾੜ ਵਿੱਚ ਬੱਚੇ ਜਾ ਤਾਂ ਨਹੀਂ ਸਕਦੇ ਪਰ ਉਹ ਦੇਖ ਕੇ ਕਿ ਪੁਲਾੜ ਵਿੱਚ ਕਿਸ ਤਰ੍ਹਾਂ ਨਾਲ ਉੱਥੇ ਕੀ ਕੀ ਹੁੰਦਾ ਹੈ ਅਤੇ ਸਾਰਾ ਗਿਆਨ ਜੋ ਹੈ ਉਹਨਾਂ ਨੂੰ ਤਕਨਾਲੋਜੀ ਤੋਂ ਮਿਲ ਰਿਹਾ ਹੈ ਬੱਚੇ ਦੀ ਭਾਸ਼ਾ ਵਿੱਚ ਸੁਧਾਰ ਹੋ ਰਿਹਾ ਹੈ ਕਿਉਂਕਿ ਬੱਚਾ ਨਵੀਆਂ ਨਵੀਆਂ ਖੋਜਾਂ ਨਵੀਂ ਨਵੀਂ ਤਕਨੀਕਾਂ ਸਿੱਖ ਰਿਹਾ ਹੈ ਬੱਚੇ ਜੋ ਹਨ ਉਹ ਦੇਖ ਕੇ ਜ਼ਿਆਦਾ ਸਿੱਖਦੇ ਹਨ ਸੁਣ ਕੇ ਤਾਂ ਇਸ ਤਕਨਾਲੋਜੀ ਨੇ ਜਿੱਥੇ ਬੱਚਿਆਂ ਦੇ ਵਿਕਾਸ ਵਿੱਚ ਵਾਧਾ ਕੀਤਾ ਹੈ ਉੱਥੇ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਵੀ ਆਪਣਾ ਬਹੁਤ ਯੋਗਦਾਨ ਪਾਇਆ ਹੈ ਅਤੇ ਨਵੇਂ ਨਵੇਂ ਪ੍ਰਾਜੈਕਟ ਜੋ ਆ ਰਹੇ ਹਨ ਉਹ ਵੀ ਬੱਚੇ ਤਕਨਾਲੋਜੀ ਦੀ ਮਦਦ ਨਾਲ ਉਹਨਾਂ ਨੂੰ ਸਿਰੇ ਚੜ੍ਹਾ ਰਹੇ ਹਨ ਬੱਚੇ ਕੰਪਿਊਟਰ ਲੈਪਟਾਪ ਅਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਜੋ ਹੈ ਸਿੱਖ ਰਹੇ ਹਨ ਅਤੇ ਇਹਨਾਂ ਦਾ ਪੂਰਾ ਫਾਇਦਾ ਉਠਾ ਰਹੇ ਹਨ ਅੱਜ ਕੱਲ੍ਹ ਸਕੂਲਾਂ ਵਿੱਚ ਵੀ ਕੰਪਿਊਟਰ ਦੀ ਐਜੂਕੇਸ਼ਨ ਜੋ ਹੈ ਬਹੁਤ ਲਾਜ਼ਮੀ ਹੋ ਚੁੱਕੀ ਹੈ ਅਤੇ ਬੱਚੇ ਪ੍ਰੋਜੈਕਟਰ ਅਤੇ ਐਲ ਈ ਡੀਸ ਦੀ ਮਦਦ ਨਾਲ ਬਹੁਤ ਕੁਝ ਸਿੱਖ ਰਹੇ ਹਨ ਅਤੇ ਉਹਨਾਂ ਨੂੰ ਬੜਾ ਲਾਭ ਹੋ ਰਿਹਾ ਹੈ